ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਸਰ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਠਾਕ ਹੋ ਥੈਂਕ ਯੂ ਹਾਂਜੀ ਹਾਂਜੀ ਹਾਂਜੀ ਸਰ ਮੈਂ ਪਹਿਲੀ ਵਾਰ ਵਿਜ਼ਿਟ ਕਰ ਰਹੀ ਹਾਂ ਮੈਨੂੰ ਇਸ ਤਰ੍ਹਾਂ ਸੀਗਾ ਕਿ ਵੀ ਕੋਈ ਜਾਣਾ ਮੈਨੂੰ ਗਾਈਡ ਕਰ ਸਕੇ ਕਿ ਕਿਸ ਤਰ੍ਹਾਂ ਹੈਗਾ ਹੈ ਉੱਥੇ ਕਿੱਦਾਂ ਦੇਖ ਸਕਦੇ ਹਾਂ ਕਿੰਨਾ ਟਾਈਮ ਘੁੰਮ ਸਕਦੇ ਹਾਂ ਕਿਹੜੀਆਂ ਕਿਹੜੀਆਂ ਜਗ੍ਹਾ ਉੱਥੇ ਅਸੀਂ ਵਿਜ਼ਿਟ ਕਰਾਂਗੇ ਹੈ ਨਾ ਅਤੇ ਮੈਨੂੰ ਤੁਹਾਡਾ ਨੰਬਰ ਰੈਫਰੈਂਸ ਦਿੱਤਾ ਸੀਗਾ ਕਿ ਬਹੁਤ ਅੱਛੇ ਟੂਰਿਸਟ ਗਾਈਡ ਨੇ ਅਤੇ ਤੁਹਾਨੂੰ ਬਹੁਤ ਅੱਛੀਆਂ ਅੱਛੀਆਂ ਪਲੇਸਿਸ ਘਮਾਉਣਗੇ ਅਤੇ ਤੁਸੀਂ ਉਹਨਾਂ ਨਾਲ ਬਹੁਤ ਵਧੀਆ ਸੇਫ ਵੀ ਹੋ ਉਸ ਜਗ੍ਹਾ ਦੇ ਵਿੱਚ ਜਾ ਕੇ ਤਾਂ ਸਾਡੇ ਰੈਲੇਟਿਵਸ ਆਏ ਸੀ ਤੁਸੀਂ ਵੀ ਪਹਿਲਾਂ ਵੀ ਉਹਨਾਂ ਨੂੰ ਲੈ ਕੇ ਗਏ ਸੀ ਕਿਤੇ ਅਤੇ ਹਾਂਜੀ ਜੀ

ਅੱਛਾ ਜੀ ਹਾਂਜੀ ਹਾਂਜੀ ਸਰ ਪੰਜਾਬ ਤੋਂ ਲੁਧਿਆਣਾ ਤੋਂ ਹਾਂ ਅਤੇ ਹਾਂਜੀ ਹਾਂਜੀ ਹਾਂਜੀ ਅੱਛਾ ਅੱਛਾ ਅੱਛਾ ਅੱਛਾ ਉਹ ਸਾਡੇ ਨੇੜੇ ਹੈ ਜੀ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਰ ਕਿਹੜੀਆਂ ਕਿਹੜੀਆਂ ਕਿਹੜੀਆਂ ਹੋਰ ਪਲੇਸਿਸ ਹੈਗੀਆਂ ਨੇ ਇਹ ਤਾਂ ਚੱਲੋ ਅਸੀਂ ਵੇਖਣਾ ਹੀ ਵੇਖਣਾ ਮਹਾਰਾਜਾ ਰਣਜੀਤ ਲਾਹੌਰ ਦਾ ਜਿਹੜਾ ਫੋਰਟ ਹੈਗਾ ਇੱਥੇ ਸਪੈਸ਼ਲੀ ਅਸੀਂ ਵੇਖਣ ਵਾਸਤੇ ਆਏ ਹਾਂ ਅਤੇ ਇਹਦੇ ਜਿਹੜੀਆਂ ਆਸ ਪਾਸ ਜਿਹੜੀਆਂ ਜਗ੍ਹਾ ਹੈਗੀਆਂ ਲਾਹੌਰ ਦੀਆਂ ਹੋਰ ਕਿਹੜੀਆਂ ਕਿਹੜੀਆਂ ਜਗ੍ਹਾ ਪ੍ਰਸਿੱਧ ਨੇ ਇੱਥੋਂ ਦੀਆਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਕ ਸਰ ਉੱਥੇ ਵੀ ਬਣਿਆ ਹੋਇਆ ਜੀ ਮਹਾਰਾਜਾ ਰਣਜੀਤ ਸਿੰਘ ਮਿਊਜ਼ੀਅਮ ਹੈਗਾ ਇੱਥੇ ਅਤੇ ਅੱਛਾ ਜੀ ਅੱਛਾ ਜੀ ਚੱਲੋ ਬਹੁਤ ਵਧੀਆ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ

ਅੱਛਾ ਜੀ ਅੱਛਾ ਜੀ ਅੱਛਾ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਬਹੁਤ ਸੋਹਣੀ ਬਹੁਤ ਸੋਹਣੀ ਸੀਨਰੀ ਹੈ ਜੀ ਬਹੁਤ ਸੋਹਣੀ ਦੇਖਣ ਨੂੰ ਵੀ ਬਹੁਤ ਹੀ ਸ ਸੋਹਣੀ ਲੱਗ ਰਹੀ ਹੈ ਦ੍ਰਿਸ਼ ਵੀ ਬੜਾ ਸੋਹਣਾ ਇਹਦਾ ਹਾਂਜੀ

ਹਾਂਜੀ ਜੀ ਹਾਂਜੀ ਹਾਂਜੀ ਸੀਨਰੀਜ਼ ਦੇ ਵਿੱਚ ਵੀ ਕਾਫ਼ੀ ਉਹਨਾਂ ਦਾ ਪੁਰਾਣੇ ਸਮੇਂ ਦੀਆਂ ਝਲਕ ਨਜ਼ਰ ਆ ਰਹੀਆਂ ਨੇ ਬਹੁਤ ਹੀ ਸੋਹਣਾ ਬਣਿਆ ਹੋਇਆ ਇਹ ਅੱਛਾ ਜੀ ਹੋਰ ਅੱਛਾ ਅੱਛਾ ਜੀ ਅੱਛਾ ਜੀ ਅੱਛਾਆ ਜੀ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ ਨਹੀਂ ਬਹੁਤ ਵਧੀਆ ਗੱਲ ਆ ਸਾਰੇ ਧਰਮਾਂ ਨੂੰ ਇੱਕੋ ਜਗ੍ਹਾ ਦੇ ਉੱਤੇ ਇਕੱਠਾ ਕਰਕੇ ਕਿਸੇ ਨੂੰ ਉੱਚਾ ਨੀਵਾਂ ਨਾ ਦਿਖਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਦਰਸਾਇਆ ਹੋਇਆ ਜੀ ਇਹ ਇਹ ਬਹੁਤ ਅੱਛੀ ਚੀਜ਼ ਹੈ ਇਹ ਹੈ ਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਸੋ ਮੱਚ ਬਹੁਤ ਅੱਛਾ ਤੁਸੀਂ ਦੱਸਿਆ ਜੀ ਇਹਦੇ ਬਾਰੇ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਓਕੇ